ਸਾਡੇ ਭਾਈਚਾਰੇ ਵਿੱਚ ਬਹੁਤ ਸਾਰੇ ਸਮਾਗਮ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਕੋਈ ਵੀ ਸਮਾਗਮ ਹੁੰਦਾ ਕੋਈ ਵੀ ਵਿਆਹ ਹੋਵੇ ਜਾਂ ਕੋਈ ਵੀ ਹੋਰ ਪ੍ਰੋਗਰਾਮ ਹੋਵੇ ਘਰ ਵਿੱਚ ਗੁਰੂ ਮਹਾਰਾਜ ਦਾ ਪਾਠ ਰਖਾਇਆ ਹੋਵੇ ਜਾਂ ਫਿਰ ਤਿਉਹਾਰ ਹੋਣ ਜਿਵੇਂ ਦਿਵਾਲੀ ਦੁਸ਼ਹਿਰਾ ਲੋਹੜੀ ਵਿਸਾਖੀ ਇਹਨਾਂ ਵਿੱਚ ਵੀ ਸਾਰਾ ਭਾਈਚਾਰਾ ਇਕੱਠਾ ਹੋ ਜਾਂਦਾ ਤਿਉਹਾਰ ਮਨਾਉਣ ਲਈ ਅਤੇ ਫਿਰ ਮਿਲ ਕੇ ਸਾਰੇ ਮਸਤੀ ਕਰਦੇ ਨੇ ਇਕੱਠੇ ਬਹਿ ਕੇ ਗੱਲਾਂ ਕਰਦੇ ਹਾਂ ਖਾਂਦੇ ਪੀਂਦੇ ਹਾਂ ਪਾਰਟੀ ਕਰਦੇ ਹਾਂ ਅਤੇ ਹੋਰ ਵੀ ਜਾਣੀ ਸਾਰਾ ਭਾਈਚਾਰਾ ਇਹਨਾਂ ਦਿਨਾਂ ਵਿੱਚ ਇਕੱਠਾ ਹੋ ਜਾਂਦਾ ਏ ਘਰ ਵਿੱਚ ਜਦੋਂ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਫਿਰ ਹੋਰ ਵੀ ਕਿਸੇ ਦਾ ਉਹ ਜਨਮਦਿਨ ਹੋਵੇ ਕੁਝ ਵੀ ਹੋਵੇ ਤਾਂ ਵੀ ਭਾਈਚਾਰਾ ਸਾਰਾ ਇਕੱਠਾ ਹੋ ਜਾਂਦਾ ਸਾਰੇ ਚਾਚੇ ਤਾਏ ਇਕੱਠੇ ਹੋ ਜਾਂਦੇ ਨੇ ਘਰ ਦੇ ਵਿੱਚ ਅਤੇ ਪ੍ਰਸਿੱਧ ਭਾਈਚਾਰਕ ਸੱਭਿਆਚਾਰਾਂ ਵਿੱਚ ਤਾਂ ਵਿਆਹ ਹੋ ਗਏ ਤਿਉਹਾਰ ਹੋ ਗਏ ਹੋਰ ਜਿਹੜੇ ਮਾੜੇ ਮੋਟੇ ਪ੍ਰੋਗਰਾਮ ਨੇ ਸਾਰੇ ਇਹਦੇ ਵਿੱਚ ਹੀ ਆਉਂਦੇ ਨੇ ਕਿਉਂਕਿ ਜਦੋਂ ਵੀ ਇਦਾਂ ਦਾ ਕੁਝ ਕਰਨਾ ਹੁੰਦਾ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਸਾਰਾ ਭਾਈਚਾਰਾ ਇਕੱਠਾ ਹੋ ਜਾਂਦਾ ਏ